ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਹੀ ਕੰਮ ਹੈ ਕਿਉਂਕਿ ਅੱਜ ਕੱਲ੍ਹ ਔਰਤਾਂ ਮਰਦਾਂ ਦੇ ਬਰਾਬਰ ਹੀ ਕੰਮ ਕਰਦੀਆਂ ਹਨ ਅਤੇ ਉਹਨਾਂ ਨੂੰ ਦੀ ਪੂਰੀ ਸਹਾਇਤਾ ਕਰਦੀਆਂ ਹਨ ਔਰ ਅੱਜ ਕੱਲ੍ਹ ਹੋਟਲਾਂ ਵਿੱਚ ਔਰਤਾਂ ਨਾਲੋਂ ਜ਼ਿਆਦਾ ਮਰਦ ਕੰਮ ਕੁਕਿੰਗ ਦਾ ਕਰਦੇ ਹਨ ਸਾਡੇ ਘਰ ਮੈਂ ਵੀ ਕੁਕਿੰਗ ਰੋਟੀ ਦਾਲ ਸਬਜ਼ੀ ਬਣਾ ਲੈਂਦਾ ਹਾਂ ਅਤੇ ਮੇਰੇ ਮੇਰਾ ਭਰਾ ਵੀ ਕਰ ਲੈਂਦਾ ਹੈ ਸਾਡੇ ਘਰ ਜ਼ਿਆਦਾਤਰ ਮਰਦ ਕੰਮ ਕਰ ਲੈਂਦੇ ਹਨ ਅਤੇ ਰੋਟੀ ਪਾਣੀ ਬਣਾ ਲੈਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਹੀ ਔਰਤ ਦੇ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ